ਇੱਕ ਮਈ ਉੱਨੀ ਸੌ ਤਿਹੱਤਰ ਇਕੱਤੀ ਮਈ ਦੋ ਹਜ਼ਾਰ ਸੱਤ ਚਾਰ ਦਸੰਬਰ ਦੋ ਹਜ਼ਾਰ ਤਿੰਨ ਚੋਦ੍ਹਾਂ ਜਨਵਰੀ ਦੋ ਹਜ਼ਾਰ ਚਾਰ ਅਠਾਰਾਂ ਨਵੰਬਰ ਉੱਨੀ ਸੌ ਤਿਹੱਤਰ